ਮੇਰਾ ਪਸੰਦੀਦਾ ਗੀਤ ਹੋ ਤੇਰੀ ਸਤੁਤੀ ਔਰ ਅਰਾਧਨਾ ਹੈ ਇੱਥੇ ਗੀਤ ਦੇ ਬੋਲ ਬਹੁਤ ਹੀ ਜ਼ਿਆਦਾ ਸੁੰਦਰ ਹਨ ਅਤੇ ਇਸ ਇਹ ਗੀਤ ਬਹੁਤ ਹੀ ਜ਼ਿਆਦਾ ਮਿੱਠਾ ਅਤੇ ਸਕੂਨ ਦੇਣ ਵਾਲਾ ਹੈ ਇਸ ਗੀਤ ਨੂੰ ਸੁਣਨ ਅਤੇ ਗਾਉਣ ਨਾਲ ਮੈਨੂੰ ਬਹੁਤ ਹੀ ਚੰਗਾ ਮਹਿਸੂਸ ਹੁੰਦਾ ਹੈ ਇਸ ਵਿੱਚ ਪਰਮੇਸ਼ਰ ਪਿਤਾ ਦੀ ਅਰਾਧਨਾ ਬਾਰੇ ਗੱਲ ਕੀਤੀ ਗਈ ਹੈ ਅਤੇ ਕਿ ਉਹ ਕਿੰਨਾਂ ਮਹਾਨ ਹੈ ਅਤੇ ਸਾਨੂੰ ਕਿੱਦਾਂ ਹਮੇਸ਼ਾਂ ਆਪਣੀ ਦਇਆ ਅਤੇ ਰਹਿਮਤਾਂ ਵਿੱਚ ਡੁਬਾ ਕੇ ਰੱਖਦਾ ਹੈ